ਸਾਡੇ ਖੇ ਪੰਜਾਬ ਦੇ ਖੇਤਰਾਂ ਵਿੱਚ ਜੰਗਲੀ ਜੀਵ ਜੰਤੂ ਹੈਗੇ ਜਿਹੜੇ ਜੀ ਜੰਗਲਾਂ ਵਿੱਚ ਹੀ ਰਹਿੰਦੇ ਨੇ ਜੰਗਲੀ ਜੀਵ ਜੰਤੂਆਂ ਦੇ ਨਿਵਾਸ ਸਥਾਨ ਵੱਖ ਵੱਖ ਹੁੰਦੇ ਹਨ ਜਿਵੇਂ ਕਿ ਪੰਛੀਆਂ ਦੇ ਦਰੱਖਤਾਂ ਦੇ ਉੱਪਰ ਨਿਵਾਸ ਸਥਾਨ ਹੁੰਦੇ ਹਨ ਉਹ ਪੰ ਪੰਛੀ ਹੈਗੇ ਜਿਹੜੇ ਆਪਦਾ ਆਲ੍ਹਣਾ ਹੈਗਾ ਉਹ ਦਰੱਖਤਾਂ ਦੇ ਉੱਪਰ ਬਣਾਉਂਦੇ ਹਨ ਜਿਹੜੇ ਵੱਡੇ ਪੰਛੀ ਹੁੰਦੇ ਹਨ ਉਹ ਆਪਦਾ ਆਲ੍ਹਣਾ ਹੈਗਾ ਜਿਹੜਾ ਵੱਡੇ ਦਰੱਖਤਾਂ ਦੇ ਉੱਪਰ ਬਣਾਉਂਦੇ ਹਨ ਅਤੇ ਜਿਵੇਂ ਕਿ ਚਿੜੀਆਂ ਆਪਦੇ ਘੌਂਸਲੇ ਬਣਾਉਂਦੀਆਂ ਹਨ ਉਹਦੇ ਵਿੱਚ ਉਹ ਆਪਦੇ ਮਤਲਬ ਕਿ ਉਹਦੇ ਵਿੱਚ ਰਹਿੰਦੀਆਂ ਹਨ ਅਤੇ ਉਹਦੇ ਵਿੱਚ ਉਹਨਾਂ ਦਾ ਨਿਵਾਸ ਸਥਾਨ ਹੁੰਦਾ ਹੈ ਇਸ ਤੋਂ ਬਿਨਾ ਜਿਹੜੇ ਜੰ ਜੰਗਲੀ ਜਾਨਵਰ ਹੁੰਦੇ ਨੇ ਜਿਵੇਂ ਕਿ ਖਰਗੋਸ਼ ਹੁੰਦੇ ਨੇ ਉਹ ਨੀਚੇ ਹੇਠਾਂ ਧਰਤੀ ਦੇ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ ਠੰਡੀ ਜਗ੍ਹਾ 'ਤੇ ਰਹਿਣਾ ਪਸੰਦ ਕਰਦੇ ਹਨ ਉਹ ਘੁਰਨੇ ਬਣਾਉਂਦੇ ਹਨ ਘੁਰਨਿਆਂ ਦੇ ਵਿੱਚ ਉਹ ਮਿੱਟੀ ਪੱਟ ਕੇ ਧਰਤੀ ਦੇ ਅੰਦਰ ਰਹਿੰਦੇ ਹਨ ਜਿਹੜੀ ਗਾਂ ਜੰਗਲੀ ਜੀਵ ਜੰਤੂਆਂ ਦੇ ਵਿੱਚ ਜਿਵੇਂ ਸ਼ੇਰ ਹੁੰਦਾ ਹੈ ਉਹ ਉਹਨਾਂ ਦੀ ਅਲੱਗ ਗੁਫਾ ਹੁੰਦੀ ਹੈ ਇਸ ਤਰ੍ਹਾਂ ਜਿਵੇਂ ਜਿਵੇਂ ਅਲੱਗ ਅਲੱਗ ਜੰਤ ਜੀਵ ਜੰਤੂ ਹੁੰਦੇ ਹਨ ਉਹਨਾਂ ਦਾ ਅਲੱਗ ਅਲੱਗ ਨਿਵਾਸ ਸਥਾਨ ਹੁੰਦੇ ਹਨ ਉਹਨਾਂ ਦੇ ਰਹਿਣ ਸਹਿਣ ਦਾ ਅਲੱਗ ਅਲੱਗ ਤਰੀਕਾ ਹੁੰਦਾ ਹੈ ਉਹਨਾਂ ਦੀ ਉਹਦਾ ਨਿਵਾਸ ਸਥਾਨ ਵਾਤਾਵਰਨ ਦੇ ਹਿਸਾਬ ਦੇ ਨਾਲ ਬਦਲਦੇ ਰਹਿੰਦੇ ਹਨ ਜਿਹੜੇ ਜੀਵ ਜੰਤੂ ਠੰਡੀਆਂ ਥਾਵਾਂ 'ਤੇ ਰਹਿਣਾ ਪਸੰਦ ਕਰਦੇ ਹਨ ਉਹ ਠੰਡੀ ਜਗ੍ਹਾ ਉੱਤੇ ਜਾਂਦੇ ਹਨ ਜਿਵੇਂ ਕਿ ਹਾਈ ਗਲੋ ਹੋ ਗਿਆ ਇਹਦੇ ਵਿੱਚ ਰਹਿੰਦੇ ਹਨ ਹੈ ਨਾ ਅਲੱਗ ਅਲੱਗ ਜਿਹੜੇ ਜੀਵ ਜੰਤੂ ਉਹ ਵਾਤਾਵਰਨ ਦੇ ਹਿਸਾਬ ਦੇ ਨਾਲ ਉਹਨਾਂ ਦੇ ਰਹਿਣ ਸਹਿਣ ਦਾ ਫਰਕ ਹੁੰਦਾ ਹੈ ਅਤੇ ਉਹ ਆਪਣਾ ਜਿਹੜਾ ਨਿਵਾਸ ਸਥਾਨ ਹੁੰਦਾ ਉਸ ਹਿਸਾਬ ਨਾਲ ਉਹਨਾਂ ਦੇ ਜਿਹੜੇ ਹੁੰਦੇ ਹੈਗੇ ਜੀਵਨ ਜੰਗਲੀ ਜੀਵ ਹੁੰਦਾ ਹੈ ਅਤੇ ਉਹਦੀ ਰੱਖਿਆ ਲਈ ਸਾਨੂੰ ਉਹਨਾਂ ਦੇ ਇਸ ਹਿਸਾਬ ਨਾਲ ਬਣੇ ਹੁੰਦੇ ਹਨ ਕਿ ਕੋਈ ਵੀ ਦੂਸਰਾ ਜੀਵ ਜੰਤੂ ਉਸਦੇ ਅੰਦਰ ਨਾ ਆਵੇ ਜਾਂ ਉਹਨਾਂ ਨੂੰ ਉਸ ਚੀਜ਼ ਦਾ ਨਾ ਪਤਾ ਲੱਗੇ